ਸਭ ਤੋਂ ਪਹਿਲੀ ਤਸਵੀਰ ਮੈਂ ਉਦੋਂ ਕੀਤੀ ਜਦੋਂ ਮੈਂ ਆਪਣੇ ਦੋਸਤਾਂ ਨਾਲ ਪਹਾੜਾਂ ਵਿੱਚੋਂ ਘੁੰਮਣ ਲਈ ਗਿਆ ਸੀ ਉੱਥੇ ਜਾ ਕੇ ਅਸੀਂ ਬਹੁਤ ਮਸਤੀ ਕੀਤੀ ਅਤੇ ਤਸਵੀਰਾਂ ਖਿੱਚੀਆਂ ਉੱਥੇ ਮੈਂ ਸਭ ਤੋਂ ਪਹਿਲੀ ਤਸਵੀਰ ਖਿੱਚੀ ਜੋ ਕਿ ਬਹੁਤ ਜਿਆਦੇ ਵਧੀਆ ਨਿਕਲੀ ਤੇ ਉਹ ਤਸਵੀਰ ਮੈਂ ਅੱਜ ਵੀ ਆਪਣੇ ਘਰੇ ਲਗਵਾਈ ਹੋਈ ਹੈ ਤੇ ਉਹ ਤਸਵੀਰ ਮੈਨੂੰ ਬਹੁਤ ਜਿਆਦੇ ਚੰਗੀ ਲੱਗਦੀ ਹੈ ਤੇ ਉਹ ਤਸਵੀਰ ਮੈਨੇ ਆਪਣੇ ਕਮਰੇ ਵਿੱਚ ਰੱਖੀ ਹੋਈ ਹੈ ਉਹ ਤਸਵੀਰ ਮੈਂ ਵੀਹ ਸਾਲ ਦੀ ਉਮਰ ਵਿੱਚ ਕੀਤੀ ਸੀ ਜਦੋਂ ਕਿ ਉਹ ਤਸਵੀਰ ਮੇਰੇ ਲਈ ਪਹਿਲੀ ਤਸਵੀਰ ਸੀ ਤੇ ਇਹ ਤਸਵੀਰ ਮੈਨੂੰ ਬਹੁਤ ਜਿਆਦਾ ਸੋਹਣੀ ਲੱਗਦੀ ਹੈ ਤਸਵੀਰ ਖਿੱਚਣੀ ਮੈਂ ਆਪਣੇ ਸ਼ਹਿਰ ਦੇ ਫੋਟੋਗ੍ਰਾਫੀ ਕੋਲੋਂ ਸਿੱਖੀ ਜੋ ਕਿ ਮੈਨੂੰ ਬਹੁਤ ਵਧੀਆ ਕੰਮ ਸਿਖਾਇਆ ਤੇ ਬਾਅਦ ਵਿੱਚ ਮੈਂ ਬਹੁਤ ਸਾਰੀਆਂ ਤਸਵੀਰਾਂ ਖਿੱਚੀਆਂ ਤੇ ਜੋ ਮੇਰੀ ਪਹਿਲੀ ਤਸਵੀਰ ਸੀ ਉਹ ਮੈਨੂੰ ਬਹੁਤ ਪਸੰਦ ਹੈ